ਬੁਣਾਈ ਕਰਨ ਸਮੇਂ ਇਹ ਦੇਖਿਆ ਜਾਂਦਾ ਹੈ ਕਿ ਬੁਣਾਈ ਜਿਹੜੀ ਆ ਉਹ ਕਿਸ ਦੇ ਲਈ ਕਰਨੀ ਹੈ ਬੱਚੇ ਦੀ ਕਰਨੀ ਹੈ ਅਤੇ ਜੇ ਮੁੰਡੇ ਦੇ ਲਈ ਸਵੈਟਰ ਬਣਨਾ ਹੈ ਤਾਂ ਡਾਰਕ ਕਲਰ ਚੁਣੇ ਜਾਂਦੇ ਨੇ ਅਤੇ ਕੁੜੀਆਂ ਲਈ ਸਵੈਟਰ ਬਣਾਉਣਾ ਹੋਵੇ ਤੇ ਲਾਈਟ ਕਲਰ ਪਿੰਕ ਆਦਿ ਰੰਗ ਜਿਹੜੇ ਨੇ ਉਹ ਕੁੜੀਆਂ ਲਈ ਆਮ ਤੌਰ 'ਤੇ ਬਣਾਏ ਜਾਂਦੇ ਨੇ ਵੱਡੇ ਲਈ ਸਵੈਟਰ ਬਣਾਉਣਾ ਹੋਵੇ ਤਾਂ ਫਿੱਕੇ ਰੰਗ ਆਮ ਤੌਰ 'ਤੇ ਚੁਣ ਲਏ ਜਾਂਦੇ ਨੇ ਅਤੇ ਜੇ ਸਟਿਚਿੰਗ ਦੀ ਗੱਲ ਕੀਤੀ ਜਾਵੇ ਤਾਂ ਫੰਕਸ਼ਨ ਫੰਕਸ਼ਨਲ ਲਈ ਜਦੋਂ ਗੂੜ੍ਹੇ ਰੰਗ ਜਿਹੜੇ ਨੇ ਚੁਣੇ ਜਾਂਦੇ ਨੇ ਸ਼ਾਦੀ ਆਦਿ 'ਤੇ ਅਤੇ ਇਸ ਤੋਂ ਇਲਾਵਾ ਕਢਾਈ ਵਾਲੇ ਸੂਟਾਂ ਦਾ ਬਹੁਤ ਜ਼ਿਆਦਾ ਰਿਵਾਜ਼ ਹੈ ਆਮ ਤੌਰ 'ਤੇ ਸੂਟ ਪਾਉਣ ਵਾਸਤੇ ਵੀ ਅੱਜ ਕੱਲ੍ਹ ਕੰਟਰਾਸਟ ਕਲਰ 'ਚ ਰੰਗ ਦੀ ਗੱਲ ਕੀਤੀ ਜਾਵੇ ਤਾਂ ਕੰਟਰਾਸਟ ਕਲਰਜ ਦਾ ਅੱਜ ਦੇ ਜ਼ਮਾਨੇ ਦੇ ਵਿੱਚ ਬਹੁਤ ਰਿਵਾਜ਼ ਚੱਲ ਰਿਹਾ ਹੈ ਓਵਰਔਲ ਸੂਟ ਜਿਹੜੇ ਨੇ ਉਹ ਬਹੁਤ ਘੱਟ ਰਹੇ ਨੇ ਹੁਣ ਦੁਬਾਰਾ ਜਿਹੜੇ ਨੇ ਉਹ ਟ੍ਰੈਂਡ 'ਚ ਆ ਰਹੇ ਨੇ ਪਰ ਇਹਦੇ ਲਈ ਜਿਹੜੇ ਨੇ ਅਲੱਗ ਅਲੱਗ ਕਲਰਜ਼ ਜਿਹੜੇ ਨੇ ਉਹ ਚੁਣੇ ਜਾਂਦੇ ਨੇ ਅਤੇ ਹੁਣ ਲੋਕਾਂ ਦਾ ਰੁਝਾਨ ਜਿਹੜਾ ਹੈ ਗੂੜੇ ਰੰਗਾਂ ਨਾਲੋਂ ਪੇਸਟਲ ਕਲਰ ਵੱਲ ਜ਼ਿਆਦਾ ਜਾ ਰਿਹਾ ਹੈ ਲੋਕ ਜਿਹੜੇ ਨੇ ਇੰਗਲਿਸ਼ ਕਲਰਜ਼ ਨੂੰ ਜ਼ਿਆਦਾ ਪ੍ਰੈਫਰ ਕਰਨ ਲੱਗ ਪਏ ਨੇ ਲੋਕ ਪਸੰਦ ਕਰਦੇ ਨੇ ਅਤੇ ਅੱਜ ਕੱਲ੍ਹ ਇੰਗਲਿਸ਼ ਕਲਰਜ਼ ਜਿਹੜੇ ਨੇ ਚੁਣ ਲਏ ਜਾਣ ਅਤੇ ਉਸ ਹਿਸਾਬ ਦੀਆਂ ਹੀ ਡਰੈਸਿਜ਼ ਬਣਵਾਈਆਂ ਜਾਂਦੀਆਂ ਨੇ ਅਤੇ ਮੇਰੇ ਮਨਪਸੰਦ ਜਿਹੜੇ ਰੰਗ ਨੇ ਉਹ ਪਿੰਕ ਅਤੇ ਬਲਿਊ ਹੈ ਨੀਲਾ ਅਤੇ ਗੁਲਾਬੀ ਇਹ ਦੋਨੋਂ ਰੰਗ ਮੈਨੂੰ ਬਹੁਤ ਪਸੰਦ ਨੇ ਮੈਂ ਕਿਤੇ ਵੀ ਜਾਵਾਂ ਕੋਈ ਵੀ ਜਦੋਂ ਕੋਈ ਡਰੈਸ ਖਰੀਦਣੀ ਹੋਵੇ ਕੋਈ ਕੱਪੜਾ ਖਰੀਦਣਾ ਹੋਵੇ ਤਾਂ ਮੈਨੂੰ ਇਹਨਾਂ ਦੋਨਾਂ ਰੰਗਾਂ ਦੇ ਵਿੱਚੋਂ ਕੱਪੜਾ ਖਰੀਦ ਕੇ ਬਹੁਤ ਮਜ਼ਾ ਆਉਂਦਾ ਹੈ